ਹੈਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਵ ਆਰ ਯੂ ਵੈਰੀ ਵੈਲ ਦੱਸੋ ਜੀ ਓਕੇ ਬੇਟਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਗ੍ਰੈਜੂਏਸ਼ਨ ਕਿਹੜੇ ਕਿਹੜੇ ਸਬਜੈਕਟ ਦੇ ਨਾਲ ਕੀਤੀ ਹੋਈ ਹੈ ਓਕੇ ਤੁਸੀਂ ਤਾਂ ਬਹੁਤ ਵਧੀਆ ਬੇਟਾ ਸਾਇੰਸ ਸਟਰੀਮ ਤਾਂ ਬੱਚੇ ਬਹੁਤ ਘੱਟ ਲੈਂਦੇ ਨੇ ਅਤੇ ਤੁਹਾਡੇ ਮਾਰਕਸ ਵਗੈਰਾ ਕਿਸ ਕਿਸ ਤਰੀਕੇ ਦੇ ਨੇ ਬੇਟਾ ਓਕੇ ਬੇਟਾ ਤੁਹਾਡੇ ਘਰ ਦੀਆਂ ਕੰਡੀਸ਼ਨ ਕਿਸ ਤਰ੍ਹਾਂ ਦੀਆਂ ਨੇ ਉਹ ਕਿਸ ਤਰ੍ਹਾਂ ਦੇ ਮਤਲਬ ਫੀਸ ਵਗੈਰਾ ਅਫੋਰਡ ਕਰ ਸਕਦੇ ਨੇ ਓਕੇ ਓਕੇ ਬੇਟਾ ਫਿਰ ਇਹਦੇ ਨਾਲ ਤਾਂ ਜਿਵੇਂ ਤੁਹਾ ਤੁਸੀਂ ਦੱਸਿਆ ਉਸ ਹਿਸਾਬ ਨਾਲ ਤਾਂ ਇਹ ਵੀ ਤੁਸੀਂ ਫੈਮਲੀ ਨੂੰ ਵੀ ਸਪੋਰਟ ਕਰੋ ਅਤੇ ਆਪਣੀ ਐਜੂਕੇਸ਼ਨ ਵੀ ਅੱਗੇ ਜਾਰੀ ਰੱਖੋ ਹੈ ਨਾ ਇਸ ਤਰੀਕੇ ਦੀ ਤੁਹਾਨੂੰ ਚਾਹੀਦੀ ਹੈ ਜੇ ਕਿਉਂਕਿ ਜੇ ਆਪਾਂ ਹੁਣ ਪ੍ਰੋਫੈਸ਼ਨਲ ਕੋਰਸ ਕੋਈ ਵੀ ਕਰਦੇ ਹਾਂ ਤਾਂ ਉਹ ਆਪਾਂ ਨੂੰ ਜਾਂ ਤਾਂ ਰੈਗੂਲਰ ਕਰਨਾ ਪਊਗਾ ਜਾਂ ਫਿਰ ਸੀ ਸੀ ਦੇ ਥਰੂ ਕਰਨਾ ਪਊਗਾ ਤਾਂ ਇਹਦੇ ਲਈ ਬੇਟਾ ਸਭ ਤੋਂ ਬੈਸਟ ਇਹ ਹੀ ਹੈ ਕਿ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਪੋਸਟ ਗ੍ਰੈਜੂਏਸ਼ਨ ਵੀ ਨਾਲ ਜੇ ਤਾਂ ਭਰ ਸਕਦੇ ਹੋ ਠੀਕ ਹ ਨਹੀਂ ਫਿਰ ਬੀਐਡ ਕਰੋ ਬੀਐਡ ਦੇ ਨਾਲ ਤੁਹਾਡਾ ਪ੍ਰੋਫੈਸ਼ਨਲ ਕੋਰਸ ਕੰਪਲੀਟ ਹੋ ਜਾਊਗਾ ਜੇ ਤੁਹਾਡਾ ਪ੍ਰੋਫੈਸ਼ਨਲ ਕੋਰਸ ਹੋ ਜਾਊਗਾ ਤਾਂ ਤੁਸੀਂ ਇਹਨੂੰ ਕੋਰਸਪੋਡਿੰਗ ਕਰ ਲਓ ਉਹਦੇ ਨਾਲ ਨਾਲ ਤੁਸੀਂ ਆਪਣੀ ਫੈਮਲੀ ਨੂੰ ਸਪੋਰਟ ਕਰਨ ਵਾਸਤੇ ਵੀ ਕੁਛ ਨਾ ਕੁਛ ਕਰ ਸਕਦੇ ਹੋ ਪੁੱਤਰ ਅਤੇ ਇਸ ਤਰੀਕੇ ਨਾਲ ਵੀ ਫੈਮਲੀ ਦੀ ਸਪੋਰਟ ਹੋ ਜਾਊਗੀ ਅਤੇ ਤੁਹਾਡੀ ਗ੍ਰੈਜੂ ਗ੍ਰੈਜੂਏਸ਼ਨ ਦੇ ਨਾਲ ਜਿਹੜਾ ਆਪਾਂ ਪ੍ਰੋਫੈਸ਼ਨਲ ਕੋਰਸ ਹੈ ਉਹ ਹੋਜੂਗਾ ਜੇ ਤੁਹਾਡੀ ਬੀਐਡ ਕੰਪਲੀਟ ਹੁੰਦੀ ਹੈ ਤਾਂ ਤੁਸੀਂ ਅੱਗੇ ਜੋਬ ਲਈ ਵੀ ਅਪਲਾਈ ਕਰ ਸਕਦੇ ਹੋ ਪੁੱਤਰ ਕਿਉਂਕਿ ਅੱਜ ਕੱਲ੍ਹ ਤਾਂ ਇਹ ਹੀ ਹੈ ਕਿ ਗ੍ਰੈਜੂਏਸ਼ਨ ਬੇਸ 'ਤੇ ਤਾਂ ਕੋਈ ਵੀ ਜੋਬ ਜਿਹੜੀ ਆ ਫਟਾਫਟ ਅਵੇਲੇਬਲ ਆਪਾਂ ਨੂੰ ਨਹੀਂ ਹੁੰਦੇ ਠੀਕ ਹੈ ਅਤੇ ਉਹ ਪ੍ਰੋਫੈਸ਼ਨਲ ਕੋਰਸ ਜ਼ਰੂਰ ਚਾਹੀਦਾ ਚਾਹੇ ਆਪਾਂ ਪ੍ਰਾਈਵੇਟ ਜੋਬ ਹੀ ਕਰਨੀ ਹੈ ਇਸ ਲਈ ਤੁਸੀਂ ਮੇਰੀ ਸਲਾਹ ਇਹ ਹੈ ਬੇਟਾ ਤੁਸੀਂ ਜਿਹੜੀ ਲੜਕੀਆਂ ਲਈ ਵੈਲ ਜੋਬ ਹੈ ਉਹ ਬੀਐਡ ਅਤੇ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜਾ ਜਾ ਸਕਦੇ ਹੋ ਅਤੇ ਆਪਣੀ ਫੈਮਿਲੀ ਨੂੰ ਵੀ ਸਪੋਰਟ ਕਰ ਸਕਦੇ ਹੋ ਔਰ ਇਹ ਇੱਕ ਵਧੀਆ ਆਪਾਂ ਕਹਿ ਸਕਦੇ ਹਾਂ ਕਿ ਮਾਣ ਵਾਲੀ ਗੱਲ ਹੁੰਦੀ ਹੈ ਇੱਕ ਟੀਚਰ ਕਿਉਂਕਿ ਟੀਚਰ ਜਿਹੜਾ ਹੁੰਦਾ ਨੈਸ਼ਨਲ ਬਿਲਡਰ ਨੂੰ ਮੰਨਿਆ ਜਾਂਦਾ ਇਸ ਲਈ ਤੁਸੀਂ ਇੱਧਰਲੀ ਸ ਸਾਈਡ 'ਤੇ ਅਪਲਾਈ ਕਰੋ ਓਕੇ ਬੇਟਾ ਓਕੇ ਬੇਟਾ ਥੈਂਕ ਯੂ